ਜਿਵੇਂ ਕਿ ਕਰੋਨਾ ਮਹਾਂਮਾਰੀ ਦੇ ਆਉਣ ਨਾਲ ਪਹਿਲਾਂ ਸਮੇਂ ਵਿੱਚ ਬਹੁਤ ਹੀ ਕਾਰੋਬਾਰਾਂ ਵਿੱਚ ਕਈਆਂ ਵਿੱਚ ਲਾਭ ਵੀ ਹੋਏ ਅਤੇ ਕਈਆਂ ਵਿੱਚ ਹਾਨੀਆਂ ਵੀ ਹੋਈਆਂ ਕਈਆਂ ਦੇ ਕਾਰੋਬਾਰ ਤਾਂ ਇਕਦਮ ਹੀ ਚੰਗੀ ਤਰ੍ਹਾਂ ਠੱਪ ਹੋ ਗਏ ਯਾਨੀ ਕਿ ਬੰਦ ਹੋ ਗਏ ਅਤੇ ਬਹੁਤ ਹੀ ਜ਼ਿਆਦਾ ਲੋਸ ਹੋਇਆ ਕੋਈ ਬਾਹਰ ਨਹੀਂ ਸੀ ਨਿਕਲਦਾ ਜੇ ਕੀ ਨਿਕਲਦਾ ਵੀ ਸੀ ਤਾਂ ਉਸਨੂੰ ਜ਼ੁਰਮਾਨਾ ਵੀ ਪੈ ਜਾਂਦਾ ਸੀ ਕੋਈ ਦੁਕਾਨ ਨਹੀਂ ਸੀ ਖੁੱਲ੍ਹੀ ਕੋਈ ਸ਼ਹਿਰ ਬਾਜ਼ਾਰ ਵਿੱਚ ਕੋਈ ਦੁਕਾਨ ਨਹੀਂ ਸੀ ਖੁੱਲ੍ਹਦੀ ਜਿਵੇਂ ਕਿ ਕਰੋਨਾ ਆਉਣ ਨਾਲ ਕਈਆਂ ਨੂੰ ਲਾਭ ਹੋਏ ਜਿਵੇਂ ਕਿ ਮਾਸਕ ਪਾਉਣਾ ਹਰ ਇੱਕ ਬੰਦੇ ਲਈ ਜ਼ਰੂਰੀ ਕਰ ਦਿੱਤਾ ਇਸ ਦੌਰਾਨ ਕਈ ਜਿਹੜੇ ਜੋ ਕਿ ਜਿਨ੍ਹਾਂ ਦੇ ਕੰਮ ਬਹੁਤ ਹੀ ਜ਼ਿਆਦਾ ਖ਼ਰਾਬ ਹੋ ਗਏ ਸੀ ਤਾਂ ਉਹਨਾਂ ਨੇ ਆਪਣੇ ਆਪ ਮਾਸਕ ਬਣਾਉਣ ਸ਼ੁਰੂ ਕਰ ਦਿੱਤੇ ਅਤੇ ਵੇਚਣੇ ਸ਼ੁਰੂ ਕਰ ਦਿੱਤੇ ਮਾਸਕ ਦਾ ਕੰਮ ਵੀ ਕਈਆਂ ਦਾ ਬਹੁਤ ਹੀ ਅੱਗੇ ਵਧਣ ਲੱਗਾ ਅਤੇ ਮਾਸਕ ਪਾਉਣਾ ਤਾਂ ਹਰ ਇੱਕ ਲਈ ਲਾਜ਼ਮੀ ਹੀ ਸੀ ਅਤੇ ਜਿਵੇਂ ਕਿ ਮਾਸਕ ਹਰ ਇੱਕ ਦੁਕਾਨ 'ਤੇ ਦੇਖਣ ਨੂੰ ਮਿਲਦਾ ਸੀ ਆਨਲਾਈਨ ਵੀ ਮਾਸਕ ਦਾ ਕੰਮ ਸ਼ੁਰੂ ਹੋਇਆ ਅਤੇ ਹਾਨੀਆ ਇਹ ਹੋਈਆਂ ਕਿ ਜੋ ਕੀ ਵੱਡੀਆਂ ਵੱਡੀਆਂ ਫੈਕਟਰੀਆਂ ਇੰਡਸਟਰੀਸ ਐਂਡ ਬਹੁਤ ਜੇ ਜੋ ਕਿ ਚਲਦੀਆਂ ਦੁਕਾਨਾਂ ਹੈਨਾ ਉਹਨਾਂ ਦੇ ਵੀ ਨੁਕਸਾਨ ਹੋਏ ਜਿਵੇਂ ਕਿ ਬੰਦ ਹੀ ਕਰ ਦਿੱਤੀਆਂ ਖੋਲ੍ਹਣ ਹੀ ਨਹੀਂ ਦਿੰਦੇ ਸੀ ਕਿਸੇ ਦੀ ਵੀ ਰੱਸ਼ ਨਹੀਂ ਸੀ ਪੈਣ ਦਿੰਦੇ ਉਹਨਾਂ ਵਿੱਚ ਹਾਨੀਆਂ ਹੋਈਆਂ ਸਾਡਾ ਕੋਈ ਖੇਤਰ ਵਿੱਚ ਹੈ ਨਹੀਂ ਸੀ ਪਰ ਜਿਵੇਂ ਕਿ ਮੇਰੇ ਪਾਪਾ ਜਾਂਦੇ ਸੀ ਕੰਮ 'ਤੇ ਉਹਨਾਂ ਨੂੰ ਵੀ ਘਰ ਹੀ ਬੈਠਣਾ ਪਿਆ ਹੋਏ ਕਈ ਕਾਰੋਬਾਰ ਬੰਦ ਵੀ ਹੋਏ ਪਰ ਟਾਈਮ ਪਾਸ ਤਾਂ ਹੁੰਦਾ ਹੀ ਰਿਹਾ